ਹੈਲੋ ਮੈਂ ਤੁਹਾਡੀ ਕੈਬ ਬੁੱਕ ਕਰਵਾਈ ਸੀ ਤੁਸੀਂ ਕਿੱਥੇ ਹੋ ਹਾਂ ਮੈਂ ਸੁਰਜੀਤ ਹਸਪਤਾਲ ਦੇ ਸਾਹਮਣੇ ਖੜ੍ਹਾ ਤੁਸੀਂ ਦਿਖ ਨਹੀਂ ਰਹੇ ਹੋ ਅਤੇ ਕਿਹੜੀ ਸਾਈਡ ਖੜ੍ਹੇ ਹੋ ਅਤੇ ਮੈਂ ਸੁਰਜੀਤ ਹਸਪਤਾਲ ਦੇ ਸਾਹਮਣੇ ਖੜ੍ਹਾ ਤੁਸੀਂ ਐਂ ਕਰੋ ਸਾਹਮਣੇ ਆ ਜਾਉ ਗੇਟ ਦੇ ਅਤੇ ਮੈਂ ਲੇਟ ਹੋ ਰਿਹਾ ਮੈਂ ਛੇਤੀ ਜਾਣਾ ਕੰਮ ਜ਼ਰੂਰੀ ਹੈ ਮੇਰਾ